ਅਸੀਂ ਸਾਡੇ ਘਰ ਦੇ ਆਲੇ ਦੁਆਲੇ ਦੇ ਇਲਾਕਿਆ ਨੂੰ ਕੀ ਹੈ ਸਾਫ਼ ਸੁਥਰਾ ਰੱਖਣ ਲਈ ਬਹੁਤ ਸਾਰੇ ਉਪਾਅ ਕਰਦੇ ਹਾਂ ਜਿਹਨਾਂ ਦੇ ਵਿੱਚੋਂ ਕੀ ਹੈ ਅਸੀਂ ਜਿਹੜੇ ਆਸੇ ਪਾਸੇ ਕੀ ਹੈ ਪਾਣੀ ਬਿਲਕੁਲ ਵੀ ਨਹੀਂ ਖੜ੍ਹਾ ਹੋਣ ਦਿੰਦੇ ਜਿਦ ਅਗਰ ਪਾਣੀ ਥੋੜ੍ਹਾ ਬਹੁਤ ਵੀ ਖੜ੍ਹਾ ਹੁੰਦਾ ਹੈ ਤਾਂ ਅਸੀਂ ਉਸਨੂੰ ਸਫ਼ਾਈ ਕਰਵਾ ਕੇ ਅਤੇ ਦਵਾਈ ਦਾ ਕੀਟਨਾਸ਼ਕ ਦਵਾਈਆਂ ਦਾ ਕੀ ਆ ਛਿੜਕਾਅ ਕਰਵਾ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਪਰੋਪਰ ਆਪਣੇ ਆਲੇ ਦੁਆਲੇ ਦੀ ਸਫ਼ਾਈ ਲਈ ਇੱਕ ਆ ਕੀ ਹੈ ਕਰਮਚਾਰੀ ਰੱਖਿਆ ਹੋਇਆ ਹੈ ਜਿਤ ਜਿਹੜਾ ਕੀ ਹੈ ਵੇ ਰੋਜ਼ ਉਥੋਂ ਦੀ ਸਫ਼ਾਈ ਕਰਦਾ ਹੈ ਅਤੇ ਜਿਹੜੇ ਛੋਟੇ ਛੋਟੇ ਨਦੀਨ ਹੋ ਜਾਂਦੇ ਨੇ ਉਹਨਾਂ ਦ ਨੂੰ ਵੀ ਕੀ ਹੈ ਉਹ ਸਾਫ਼ ਕਰ ਜਾਂਦਾ ਹੈ ਅਤੇ ਉਹ ਕੀ ਹੈ ਮੱਖੀ ਮੱਛਰਾਂ ਤੋਂ ਜਿਹੜੀ ਰਾਹਤ ਲਈ ਅਸੀਂ ਕੀ ਹੈ ਪਰੋਪਰ ਇੱਕ ਦਵਾਈ ਦਾ ਛਿੜਕਾਅ ਕਰਵਾਉਂਦੇ ਹਾਂ ਜਿਸ ਦੇ ਨਾਲ ਕੀ ਹੈ ਮੱਖਰ ਮੱਛਰ ਅਤੇ ਮੱਖੀਆਂ ਨੇ ਜਿਹੜੀਆਂ ਉਹ ਆਸੇ ਪਾਸੇ ਨਹੀਂ ਆਉਂਦੀਆਂ ਅਤੇ ਜਿਸ ਨਾਲ ਕੀ ਹੈ ਬਿਮਾਰੀਆਂ ਦਾ ਖ਼ਤਰਾ ਨਹੀਂ ਰਹਿੰਦਾ ਇਸ ਤਰ੍ਹਾਂ ਅਸੀਂ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਦੇ ਹਾਂ